ਮੈਂ ਤੁਹਾਡੇ ਨਾਲ ਅੱਜ ਮੇਰੇ ਜੀਵਨ ਦੇ ਵਿੱਚ ਜੋ ਟੈਕਨੋਲੋਜੀ ਤਕ ਤਬਦੀਲੀਆਂ ਜੀਵਨ ਕਾਲ ਦੌਰਾਨ ਹੋਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਸਭ ਤੋਂ ਵੱਡੀਆਂ ਤਾਂ ਪ੍ਰਮੁੱਖ ਟੈਕਨੋਲਜੀ ਤਬਦੀਲੀਆਂ ਬਾਰੇ ਗੱਲ ਕਰਦੇ ਹਾਂ ਪਹਿਲਾਂ ਜਿਵੇਂ ਸਭ ਤੋਂ ਪ੍ਰਮੁੱਖ ਹੈ ਜਿਵੇਂ ਨੈਟਵਰਕਿੰਗ ਤਬਦੀਲੀਆਂ ਦੀ ਅੱਜ ਦੇ ਯੁੱਗ ਦੇ ਵਿੱਚ ਜੋ ਸਾਇੰਸ ਦਾ ਯੁਗ ਹੈ ਮੋਬਾਇਲ ਦੇ ਆਉਣ ਦੇ ਨਾਲ ਬਹੁਤ ਹੀ ਜ਼ਿਆਦਾ ਬਦਲਾਅ ਹੋਇਆ ਇਹਦਾ ਬਦਲਾਅ ਸਾਡੇ ਜੀਵਨ ਕਾਲ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਇਆ ਇਸ ਦੇ ਨਾਲ ਆਉਣ ਦੇ ਨਾਲ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਦੂਸਰੇ ਲੋਕਾਂ ਦੇ ਨਾਲ ਆਪਣੇ ਸੰਪਰਕ ਬਣਾ ਲਏ ਆਪਣੇ ਮੈਸੇਜ ਐਸ ਐਮ ਐਸ ਆਪਣੇ ਵੋਇਸ ਮੈਸੇਜ ਆਪਣੇ ਸੁਨੇਹੇ ਆਪਣੀਆਂ ਫੋਟੋਆਂ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਦਿੱਤੀਆਂ ਇਹਨਾਂ ਸੁਨੇਹਿਆਂ ਨੂੰ ਦੇਣ ਵਾਸਤੇ ਨਹੀਂ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਪਰ ਮੋਬਾਈਲ ਫੋਨ ਦੇ ਆਉਣ ਦੇ ਨਾਲ ਇਹ ਕੰਮ ਬਹੁਤ ਹੀ ਜ਼ਿਆਦਾ ਆਸਾਨ ਹੋ ਗਿਆ ਦੂਸਰੀ ਸਭ ਤੋਂ ਵੱਡੀ ਟੈਕਨੋਲੋਜੀ ਤਬਦੀਲੀ ਇਹ ਆਈ ਕਿ ਆਵਾਜਾਈ ਸਾਧਨ ਦੇ ਆਉਣ ਦੇ ਨਾਲ ਸਾਡਾ ਜੋ ਕੰਮ ਹੀ ਬਹੁਤ ਜ਼ਿਆਦਾ ਆਸਾਨ ਹੋ ਗਿਆ ਪਹਿਲਾਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਬਹੁਤ ਹੀ ਜ਼ਿਆਦਾ ਲੰਬਾ ਸਮਾਂ ਇੰਤਜ਼ਾਰ ਕਰਦੇ ਸੀ ਜਾਣ ਵਾਸਤੇ ਬਹੁਤ ਲੰਬਾ ਸਮਾਂ ਲੱਗ ਜਾਂਦਾ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਅਸੀਂ ਕਰੋੜਾਂ ਕਿਲੋਮੀਟਰ ਦਾ ਸਫ਼ਰ ਜੋ ਚੰਦ ਹੀ ਘੰਟਿਆਂ ਦੇ ਵਿੱਚ ਪੂਰਾ ਕਰ ਲੈਂਦੇ ਹਾਂ ਇਸ ਦੇ ਆਉਣ ਦੇ ਨਾਲ ਸਾਡੇ ਜੀਵਨ ਕਾਲ ਦੇ ਵਿੱਚ ਅਤੇ ਸਾਡੇ ਕੰਮ ਵਾਲੇ ਕੰਮਾਂ ਦੇ ਵਿੱਚ ਕੰਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਆ ਗਈਆਂ ਇਨਦਾ ਵੱਡਾ ਰੋਲ ਹੈ ਟੈਕਨੋਲੋਜੀ ਤਬਦੀਲੀਆਂ ਦਾ